ਚਾਰ ਮਾਰਚ ਉੱਨੀ ਸੌ ਬਾਨਵੇਂ ਛੇ ਮਈ ਉੱਨੀ ਸੌ ਸੱਠ ਅੱਠ ਜੁਲਾਈ ਉੱਨੀ ਸੌ ਨੱਬੇ ਪੰਦਰਾਂ ਸਤੰਬਰ ਉੱਨੀ ਸੌ ਅਠਾਨਵੇਂ ਇੱਕੀ ਅਕਤੂਬਰ ਦੋ ਹਜ਼ਾਰ ਇੱਕੀ